ਮੈਂ ਆਪਣੇ ਜੀਵਨ ਵਿੱਚ ਕਈ ਆਪਣੇ ਇਲਾਕੇ ਤੋਂ ਕਈ ਵਾਰ ਬਾਹਰ ਗਿਆ ਪਰ ਕਈ ਵਾਰ ਮੈਂ ਇੱਦਾਂ ਦਾ ਵੀ ਇੱਦਾਂ ਦਾ ਵੀ ਗਿਆ ਕਿ ਉੱਥੇ ਉੱਥੇ ਦੇ ਇਲਾਕੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਕਿ ਹਿਮਾਚਲ ਸਾਇਡ ਦੀ ਹੈ ਨਾ ਹਿਮਾਚਲ ਸਾਇਡ 'ਚ ਉਨ੍ਹਾਂ ਦਾ ਵਿਊ ਉਨ੍ਹਾਂ ਦੀ ਪ੍ਰਕਿਰਤੀ ਦੇਖਣ ਪੰਜਾਬ ਦੇ ਆਮ ਤੌਰ 'ਤੇ ਲੋਕ ਜਾਂਦੇ ਹੀ ਰਹਿੰਦੇ ਹਨ ਠੀਕ ਹੈ ਜਿਹੜੇ ਉੱਥੋਂ ਦੇ ਲੋਕ ਹੈ ਉਹ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੇ ਬਹੁਤ ਜ਼ਿਆਦਾ ਵਿਤਕਰਾ ਕਰਦੇ ਹਨ ਉਹ ਕਹਿੰਦੇ ਏ ਕਿ ਪੰਜਾਬ ਦੇ ਲੋਕ ਅ ਚੰਗੇ ਨਹੀਂ ਹੁੰਦੇ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਆ ਬਹੁਤ ਜ਼ਿਆਦਾ ਹੁਲੜਬਾਜ਼ੀ ਕਰਦੇ ਆ ਜਾਂ ਕਹਿ ਲਉ ਵੀ ਗੰਦ ਪਾਉਂਦੇ ਆ ਠੀਕ ਆ ਉੱਥੇ ਜਾ ਕੇ ਦਾਰੂਆਂ ਦੂਰੂਆਂ ਵਗੈਰਾ ਪੀਂਦੇ ਆ ਠੀਕ ਆ ਇਸ ਕਾਰਨ ਉਨ੍ਹਾਂ ਦਾ ਬਹੁਤ ਜ਼ਿਆਦਾ ਵਿਤਕਰਾ ਕਰਦੇ ਹਨ ਠੀਕ ਹੈ ਉਹ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ ਜਿਹੜੇ ਉੱਥੇ ਦੇ ਕਹਿ ਲਉ ਕਿ ਮੁਲਾਜ਼ਮ ਵੀ ਆ ਉਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਗਲਤ ਬੋਲਦੇ ਨੇ ਜਾਂ ਪੰਜਾਬੀ ਉਨ੍ਹਾਂ ਨੂੰ ਗਲਤ ਬੋਲਦੇ ਨੇ ਕਿਉਂਕਿ ਉਨ੍ਹਾਂ ਦਾ ਇੱਕ ਤਰ੍ਹਾਂ ਦਾ ਨਜ਼ਰੀਆ ਇਸ ਹਿਸਾਬ ਨਾਲ ਬਣਿਆ ਵਾ ਕਿ ਪੰਜਾਬੀ ਹਮੇਸ਼ਾਂ ਹੁਲੜਬਾਜ਼ੀ ਕਰਦੇ ਆ ਜਾਂ ਕਹਿੰਦੇ ਆ ਵੀ ਗਲਤ ਹੀ ਬੋਲਦੇ ਆ ਠੀਕ ਹੈ ਇਸ ਕਰਕੇ ਮੈਂ ਪਹਾੜੀ ਇਲਾਕੇ ਦੇ ਲੋਕਾਂ ਨੂੰ ਪ੍ਰਤੀ ਇਹ ਵਿਤ ਵੀ ਇਹ ਵਿਤਕਰਾ ਦੇਖਿਆ ਹੈ ਕਿ ਉੱਧਰ ਦੇ ਲੋਕ ਇੱਧਰ ਦੇ ਲੋਕਾਂ ਨਾਲ ਇਹ ਵਿਤਕਰਾ ਕਰਦੇ ਹਨ ਉਨ੍ਹਾਂ ਦੀ ਸੋਚ ਹੀ ਇਸ ਹਿਸਾਬ ਨਾਲ ਹੈ ਕਿ ਇੱਧਰ ਦੇ ਲੋਕ ਹੀ ਬਹੁਤ ਜ਼ਿਆਦਾ ਵੀ ਕਹਿ ਲਉ ਵੀ ਨਿਰਾਸ਼ਨਾਈ ਹੁੰਦੇ ਹੈ ਜਾਂ ਬਹੁਤ ਜ਼ਿਆਦਾ ਗਲਤ ਬੋਲਦੇ ਹੈ ਠੀਕ ਹੈ ਉਨ੍ਹਾਂ ਦੀ ਸੋਚ ਹੀ ਉਰੀ ਤੱਕ ਹੀ ਆ